ਸਤਿ ਸ਼੍ਰੀ ਅਕਾਲ ਮੇਰਾ ਨਾਂ ਅਰਮਾਨਦੀਪ ਸਿੰਘ ਹੈ ਮੈਂ ਹਰਚੇਵਾਲ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਮੈਂ ਐਸ ਐਨ ਕਾਲਜ ਵਿੱਚ ਦੌੜ ਵਿੱਚ ਪਾਰਟੀਸਪੇਟ ਕੀਤਾ ਸੀ ਉੱਥੋਂ ਦੀ ਇੱਕ ਮੈਨੂੰ ਬਹੁਤ ਹੀ ਹਾਸੇ ਵਾਲੀ ਗੱਲ ਇਹ ਲੱਗਦੀ ਸੀ ਕਿ ਜਦੋਂ ਅਸੀਂ ਪ੍ਰੈਕਟਿਸ ਕਰਦੇ ਸੀ ਤਾਂ ਇੱਕ ਮੁੰਡਾ ਭੱਜਦਿਆਂ ਭੱਜਦਿਆਂ ਥੱਲੇ ਡਿੱਗ ਗਿਆ ਇੱਕ ਵਾਰੀ ਤਾਂ ਸਾਡੇ ਪਿੱਛੇ ਪੰਜ ਕੁੱਤੇ ਪੈ ਗਏ ਅਤੇ ਅਸੀਂ ਪ੍ਰੈਕਟਿਸ ਕਰਦੇ ਕਰਦੇ ਹੀ ਕੰਧ ਟੱਪ ਲਈ ਸਕੂਲ ਦੀ ਉਹ ਸਕੂਲ ਨੂੰ ਘਰ ਤੱਕ ਭੱਜਦੇ ਗਏ ਸਾਡੇ ਕੁੱਤਿਆਂ ਨੇ ਸਾਰੇ ਰਾਹ ਵਿੱਚ ਸਾਡਾ ਸਾਥ ਨਾ ਛੱਡਿਆ ਬਹੁਤ ਹੀ ਹਾਸੇ ਵਾਲੀ ਗੱਲ ਤਾਂ ਇਹ ਹੈ ਕਿ ਕੁੱਤਾ ਮੇਰੀ ਲੱਤ ਫੜਦਿਆਂ ਫੜਦਿਆਂ ਮੈਂ ਮਸਾਂ ਬਚਿਆ ਅਸੀਂ ਮੈਨੂੰ ਬਹੁਤ ਹਾਸਾ ਆਉਂਦਾ ਹੈ ਕਿ ਜਦੋਂ ਮੈਂ ਪ੍ਰੈਕਟਿਸ ਕਰਦਾ ਸੀ ਮੇਰੇ ਨਾਲ ਕੋਈ ਨਾ ਕੋਈ ਇੱਦਾਂ ਦੀ ਹਾਸੇ ਵਾਲਾ ਕੋਈ ਨਾ ਕੋਈ ਕਾਰਨ ਹੁੰਦਾ ਰਹਿੰਦਾ ਸੀ ਮੇਰੇ ਇੱਕ ਵਾਰੀ ਤਾਂ ਮੇਰਾ ਯਾਰ ਭੱਜਦਾ ਭੱਜਦਾ ਬਹੁਤ ਜ਼ੋਰ ਨਾਲ ਤਿਲਕਿਆ ਉਹਨੇ ਸਾਰੀ ਟੀਮ ਨੂੰ ਸੁੱਟ ਦਿੱਤਾ ਤਿਲਕ ਕੇ ਸਾਰੀ ਟੀਮ ਉਹਦੇ ਉੱਤੋਂ ਦੀ ਜੰਪ ਮਾਰਦਿਆਂ ਹੋਏ ਤਿਲਕਦੇ ਤਿਲਕਦੇ ਸਾਰੇ ਡਿੱਗੇ ਡਿੱਗ ਗਏ ਔਰ ਮੈਨੂੰ ਦੌੜ ਸਬੰਧੀ ਬਹੁਤ ਹੀ ਆਸਾਨ ਤਾਂ ਹੈ ਹੀ ਕਿ ਜਦੋਂ ਮੈਂ ਦੌੜਨ ਦੌੜਨ ਲੱਗਦਾ ਸੀ ਤਾਂ ਮੇਰਾ ਕਈ ਵਾਰੀ ਪੈਰ ਫਿਸਲ ਜਾਂਦਾ ਅਤੇ ਮੇਰਾ ਮੂੰਹ ਥੱਲੇ ਮੇਰਾ ਮੂੰਹ ਗ ਗਰਾਉਂਡ ਨਾਲ ਵੱਜ ਜਾਂਦਾ ਅਤੇ ਕਈ ਵਾਰੀ ਤਾਂ ਲਹੂ ਵਗਣਾ ਸ਼ੁਰੂ ਹੋ ਜਾਂਦਾ ਸੀ ਅਤੇ ਇੱਕ ਵਾਰੀ ਤਾਂ ਕੋਚ ਸਾਹਿਬ ਸਾਡੇ ਨਾਲ ਭੱਜਣ ਡਏ ਸੀ ਤਾਂ ਮੇਰੇ ਨਾਲ ਕੋਚ ਸਾਹਿਬ ਦੀ ਟੱਕਰ ਵੱਜ ਗਈ ਕੋਚ ਸਾਹਿਬ ਦੂਜੇ ਬੰਨੇ ਡਿੱਗ ਗਏ ਅਤੇ ਮੈਂ ਉਹਨਾਂ ਨੂੰ ਚੁੱਕਣ ਗਿਆ ਤਾਂ ਫਿਰ ਕੁੱਤੇ ਸਾਡੇ ਪਿੱਛੇ ਪੈ ਗਏ ਕੁੱਤਿਆਂ ਤੋਂ ਬਚਦੇ ਬਚਦੇ ਅਸੀਂ ਸਕੂਲ ਦੇ ਪਿੱਪਲ ਥੱਲੇ ਪਹੁੰਚੇ ਤਾਂ ਕੁੱਤੇ ਫਿਰ ਉੱਥੇ ਵੀ ਕਈ ਕੁੱਤੇ ਆ ਗਏ ਕੋਚ ਸਾਹਿਬ ਦੀ ਲੱਤ ਫੜ ਲਈ ਉਹਨਾਂ ਨੇ ਪਾਰ ਪਰ ਅਸੀਂ ਬਚ ਗਏ